ਹੈਲੋ ਨਮਸ਼ਕਾਰ ਜੀ ਹਾਂਜੀ ਅੱਛਾ ਅੱਛਾ ਸਰ ਜੀ ਨਮਸਤੇ ਜੀ

ਹਾਂਜੀ ਸਰ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਤਾਂ ਇੱਕ ਖੇਤੀ ਪ੍ਰਧਾਨ ਦੇਸ਼ ਹੈ ਇਹ ਇੱਕਦਮ ਡ ਡਿਪੈਂਡ ਹੀ ਖੇਤੀ 'ਤੇ ਹੈ ਜ਼ਿਆਦਾਤਰ ਇੱਥੋਂ ਦੇ ਕਿਸਾਨ ਜ਼ਿਆਦਾਤਰ ਖੇਤੀਬਾੜੀ 'ਤੇ ਡਿਪੈਂਡ ਨੇ ਅਤੇ ਇਹ ਜਿੰਨਾ ਜ਼ਿਆਦਾ ਖੇਤੀ 'ਚ ਵਧੀਆ ਵਧੇਗੀ ਅਤੇ ਵਧਣੀ ਵੀ ਆ ਕਿਉਂਕਿ ਨਵੇਂ ਨਵੇਂ ਅ ਅ ਮਤਲਬ ਕਿ ਖੇਤੀਬਾੜੀ ਦੇ ਤਕਨੀਕਾਂ ਆ ਰਹੀਆਂ ਐਗਰੀਕਲਚਰ 'ਚ ਜਿੰਨਾ ਚਿਰ ਇਹ ਅੱਗੇ ਚੱਲੇਗਾ ਤੇ ਉਹ ਜ਼ਿਆਦਾ ਕਮਾਈ ਕਰਨਗੇ ਨਵੇਂ ਨਵੇਂ ਤਰੀਕਿਆਂ ਦੇ ਨਾਲ ਤੇ ਤੁਸੀਂ ਇਸ 'ਤੇ ਰਿਸਰਚ ਕਰੋ ਜਿੰਨੀ ਜ਼ਿਆਦਾ ਵਧੀਆ ਹੋਏਗੀ ਤੇ ਉੱਨੀ ਜ਼ਿਆਦਾ ਇਕਨੋਮੀ ਵੀ ਵਧੇਗੀ ਇਕਨੋਮੀ ਹੋਰ ਹੋਰ ਤੁਸੀਂ ਕਦੀ ਆਇਓ ਬੈਠ ਕੇ ਗੱਲਬਾਤ ਕਰਾਂਗੇ ਇਸ ਟੋਪਿਕ 'ਤੇ ਫਿਰ ਤੁਹਾਨੂੰ ਅ ਹੋਰ ਦਿਨ ਅ ਮੇਰੇ ਨਾਲ ਦੇ ਹੋਰ ਵੀ ਹੈਗੇ ਉਨ੍ਹਾਂ ਨਾਲ ਮਿਲਾਵਾਂਗੇ ਤੁਹਾਨੂੰ ਤੇ ਦੇਖ ਲਓ ਜੀ ਓਕੇ